ਮੈਂ ਕਈ ਤਰ੍ਹਾਂ ਦੀ ਲਾਇਬ੍ਰੇਰੀਆਂ 'ਚ ਗਿਆਂ ਇੱਕ ਲੁਧਿਆਣੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਐਕਸਟੈਂਸ਼ਨ ਲਾਇਬ੍ਰੇਰੀ ਹੈ ਜੋ ਕਿ ਫਰੀ ਹੈ ਅਤੇ ਪਟਿਆਲੇ ਦੇ ਵਿੱਚ ਵੀ ਸੈਂਟਰ ਹਾਲ ਦੇ ਵਿੱਚ ਇੱਕ ਲਾਇਬ੍ਰੇਰੀ ਹੈ ਉਹ ਵੀ ਇੱਕਦਮ ਫਰੀ ਹੈ ਬਸ ਉਹ ਮੈਂਬਰਸ਼ਿਪ ਦੇ ਦਸ ਵੀਹ ਰੁਪਈਏ ਲੈਂਦੇ ਹਨ ਅਤੇ ਉਥੇ ਜਾ ਕੇ ਤੁਸੀਂ ਕਾਫੀ ਕਿਤਾਬਾਂ ਪੜ੍ਹ ਸਕਦੇ ਹੋ ਮੇਰੇ ਘਰ ਵਿੱਚ ਇੱਕ ਨਿੱਜੀ ਲਾਇਬ੍ਰੇਰੀ ਹੈ ਜਿਹਦੇ ਵਿੱਚ ਮੈਂ ਥੋੜ੍ਹੀ ਬਹੁਤ ਆਪਦੇ ਪੜ੍ਹਨ ਵਾਲੀ ਕਿਤਾਬਾਂ ਰੱਖੀਆਂ ਹੋਈਆਂ ਹਨ ਅਤੇ ਉਹ ਅ ਸ ਹਰ ਰੋਜ਼ ਪੰਦਰਾਂ ਵੀਹ ਮਿੰਟ ਉਹਨਾਂ ਦੇ ਵਿੱਚੋਂ ਦਿਨ ਦੇ ਵਿੱਚੋਂ ਕੱਢ ਕੇ ਉਹ ਕਿਤਾਬਾਂ ਪੜ੍ਹਦੇ ਹਨ ਮੇਰੇ ਸੁਪਨਿਆਂ ਦੀ ਲਾਇਬ੍ਰੇਰੀ ਹੀ ਹੋਵੇਗੀ ਕਿ ਮੈਂ ਬਹੁਤ ਇੱਕ ਮੋਟੀਵੇਸ਼ਨਲ ਕਿਤਾਬਾਂ ਹੋਣ ਜਿਹੜੀਆਂ ਉਹ ਆਪਦੀ ਲਾਇਬ੍ਰੇਰੀ 'ਚ ਰੱਖਣ ਅਤੇ ਬੱਚਿਆਂ ਨੂੰ ਅੱਗੇ ਗਾਈਡ ਕਰਾਂ